ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਸਿੰਪਲਪ੍ਰੀਤ ਗੱਲ ਕਰ ਰਹੀ ਹਾਂ ਆਪਣੇ ਸਕੂਲ 'ਚੋਂ ਪਾਸ ਆਊਟ ਹੋਏ ਹਨ ਹੁਣੇ ਟੈਂਨਥ ਕਰਕੇ ਹਾਂਜੀ ਹਾਂਜੀ ਸਰ ਵਧੀਆ ਸਰ ਆਪਣਾ ਰਿਜ਼ਲਟ ਆ ਗਿਆ ਬਹੁਤ ਅੱਛਾ ਰਿਜ਼ਲਟ ਆਇਆ ਹਾਂਜੀ ਹਾਂਜੀ ਹਾਂਜੀ ਸਰ ਬਸ ਸਾਰੇ ਵਧੀਆ ਸਰ ਹੁਣ ਤਾਂ ਨਾ ਮੈਂ ਮਤਲਬ ਅੱਗੇ ਪਲੈਨ ਕਰ ਰਹੀ ਹਾਂ ਕਿ ਅੱਗੇ ਕੀ ਕਰਨਾ ਹੈਗਾ ਉਹਦੇ ਬਾਰੇ ਹਾਂਜੀ ਸਰ ਐਕਚੁਲੀ ਨਾ ਮੇਰਾ ਪਲੈਨ ਤਾਂ ਇਹ ਹੈਗਾ ਕਿ ਮੈਨੂੰ ਮੈਥ ਦੇ ਟੀਚਰ ਬਣਨ ਦਾ ਸ਼ੌਂਕ ਹੈ ਅਤੇ ਹੁਣ ਮੈਂ ਉਹਦੇ ਬਾਰੇ ਹੀ ਪੁੱਛਣਾ ਸੀਗਾ ਕਿ ਹੁਣ ਅੱਗੇ ਮਤਲਬ ਕੀ ਚੀਜ਼ ਕੀਤੀ ਜਾਵੇ ਕਿਉਂਕਿ ਮੈਨੂੰ ਮੈਥ ਟੀਚਰ ਬਣਨ ਦਾ ਬਹੁਤ ਸ਼ੌਕ ਹੈ ਹਾਂਜੀ ਠੀਕ ਹੈ ਸਰ ਹਾਂਜੀ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਜੀ ਸਰ

ਯੈਸ ਸਰ ਸਰ ਠੀਕ ਹੈ ਹਾਂਜੀ ਓਕੇ ਜੀ ਬਿਲਕੁਲ ਸਰ ਬਿਲਕੁਲ ਯੈਸ ਸਰ ਜੀ ਸਰ

ਹਾਂਜੀ ਜੀ ਸਰ ਜੀ ਸਰ ਐਕਚੁਲੀ ਸਰ ਪੇਰੈਂਟਸ ਹਾਂਜੀ ਹਾਂਜੀ ਨਹੀਂ ਨਹੀਂ ਸਰ ਮੈਂ ਤਾਂ ਇਹ ਦੱਸਣਾ ਚਾਹ ਰਹੀ ਸੀ ਕਿ ਐਕਚੁਲੀ ਪੇਰੈਂਟਸ ਤਾਂ ਨਾ ਫੁਲ ਸਪੋਰਟ ਕਰ ਰਹੇ ਆ ਉਹ ਵੀ ਮੇਰੇ ਤੋਂ ਪੁੱਛ ਰਹੇ ਕਿ ਤੇਰਾ ਜਿਸ ਚੀਜ਼ 'ਚ ਇੰਟਰਸਟ ਹੈ ਕਿ ਅਸੀਂ ਅੱਗੇ ਉਹੀ ਚੀਜ਼ ਕਰਵਾਵਾਂਗੇ ਤੁਹਾਨੂੰ ਤਾਂ ਮੈਨੂੰ ਐਂ ਸੀ ਕੀ ਇੱਕ ਵਾਰੀ ਤੁਹਾਡੇ ਤੋਂ ਪੁੱਛ ਲਵਾਂ ਯੈਸ ਸਰ ਯੈਸ ਸਰ ਜੀ ਸਰ ਜੀ ਸਰ ਠੀਕ ਹੈ ਸਰ ਜੀ ਜੀ ਸਰ ਜੀ ਸਰ ਜੀ ਸਰ ਯੈਸ ਸਰ ਹਾਂਜੀ

ਜੀ ਸਰ ਜੀ ਸਰ ਠੀਕ ਹੈ ਸਰ ਠੀਕ ਹੈ ਸਰ ਜੀ ਸਰ ਜੀ ਸਰ ਜੀ ਠੀਕ ਹੈ ਸਰ ਜੀ ਸਰ ਜੀ ਜੀ ਹਾਂਜੀ ਚਲੋ ਸਰ ਠੀਕ ਹੈ ਸਰ ਹਾਂਜੀ ਠੀਕ ਹੈ ਸਰ ਹਾਂਜੀ ਹਾਂਜੀ ਠੀਕ ਹੈ ਸਰ ਓਕੇ ਓਕੇ ਠੀਕ ਹੈ ਸਰ ਓਕੇ